ਹਾਂਜੀ ਮੈਂ ਆਪਣੇ ਜਿੱਦਾਂ ਲਿਖਤ ਦੇ ਵਿੱਚ ਜਿਹੜੀਆਂ ਪਰੰਪਰਾਵਾਂ ਅਲੋਪ ਹੋ ਰਹੀਆਂ ਹੈ ਨਾ ਜਿਵੇਂ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਜੋ ਕੁਛ ਵੀ ਰੀਤੀ ਰਿਵਾਜ਼ ਅਸੀਂ ਪੁਰਾਣੇ ਸਮਿਆਂ ਤੋਂ ਕਰਦੇ ਆ ਰਹੇ ਹਾਂ ਹੁਣ ਉਹ ਅਲੋਪ ਹੋ ਰਹੇ ਹੈ ਜਿਵੇਂ ਆਪਾਂ ਕਲੀਰੇ ਬੰਨਦੇ ਹਾਂ ਵਿਆਹ ਦੇ ਵੇਲੇ ਕਿਉਂ ਬੰਨਦੇ ਹਾਂ ਕਿਸੇ ਨੂੰ ਪਤਾ ਨਹੀਂ ਹੈਗਾ ਜਾਂ ਅੱਜ ਦਾ ਮਤਲਬ ਕੋਈ ਸੁਹਾਗ ਗਾਉਂਦੀਆਂ ਅਸੀਂ ਪੁਰਾਣੇ ਸਮਿਆਂ ਦੇ ਵਿੱਚ ਗੀਤ ਗਾਉਂਦੀਆਂ ਸੀਗੀਆਂ ਸਾਡੀਆਂ ਬਜ਼ੁਰਗ ਅਤੇ ਉਹਨਾਂ ਲਈ ਉਹ ਉਹ ਚੀਜ਼ਾਂ ਨੂੰ ਸਮੇਟਣਾ ਮੈਂ ਆਪਣੀਆਂ ਲਿਖਤਾਂ ਵਿੱਚ ਇਕੱਠਾ ਕਰਦੀ ਹਾਂ ਕਿ ਉਹਨਾਂ ਦੇ ਬਾਰੇ ਮੈਂ ਜ਼ਿਆਦਾ ਤੋਂ ਜ਼ਿਆਦਾ ਲਿਖ ਸਕਾਂ ਹੈ ਨਾ ਪੰਜਾਬੀ ਦੀਆਂ ਅਲੋਪ ਹੋ ਰਹੀਆਂ ਜਿਹੜੀਆਂ ਕਥਾਵਾਂ ਆ ਉਹਨਾਂ ਨੂੰ ਆਪਣੇ ਬੱਚਿਆਂ ਲਈ ਉਹਨਾਂ ਦੀ ਸਿੱਖਿਆ ਵਾਸਤੇ ਸਮੇਟ ਸਕਾਂ ਅਤੇ ਆਪਣਾ ਜੋ ਕਲਚਰ ਹੈਗਾ ਹੈ ਨਾ ਜਿਹੜਾ ਮਤਲਬ ਤੁਸੀਂ ਕਹਿ ਲਓ ਜਿੱਦਾਂ ਵਿਆਹਾਂ ਦੇ ਵਿੱਚ ਵੀ ਕਈ ਰੀਤੀ ਰਿਵਾਜ਼ ਹੁੰਦੇ ਆ ਜਾਂ ਜਦੋਂ ਕਹਿ ਲਓ ਕਿ ਕੁੜੀ ਨੂੰ ਵਟਣਾ ਲਗਾਉਂਦੇ ਉਦੋਂ ਉਸ ਟਾਈਮ 'ਤੇ ਵਟਨੇ ਦਾ ਕੀ ਮਤਲਬ ਸੀਗਾ ਅਤੇ ਅੱਜ ਉਹ ਚੀਜ਼ਾਂ ਅਲੋਪ ਹੋ ਰਹੀਆਂ ਬੱਚੇ ਨਹੀਂ ਪਸੰਦ ਕਰਦੇ ਹੈ ਨਾ ਅਤੇ ਬਸ ਉਹਨਾਂ ਨੂੰ ਆਪਣੇ ਜਿਹੜੀਆਂ ਪਰੰਪਰਾਵਾਂ ਚੱਲ ਰਹੀਆਂ ਉਹਨਾਂ ਨੂੰ ਆਪਣੀ ਲਿਖਣ ਵਿੱਚ ਸ਼ਾਮਲ ਕਰਾਂ ਤਾਂ ਜੋ ਅਗਲੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਦਾ ਪਤਾ ਲੱਗ ਸਕੇ ਕਈ ਇਗਜਾਮਪਲਾਂ ਹੈਗੀਆਂ ਹੁਣ ਆਪਾਂ ਆਪਣੇ ਸੱਭਿਆਚਾਰ ਬਾਰੇ ਅਸੀਂ ਇਹਨਾਂ ਚੀਜ਼ਾਂ ਨੂੰ ਸਮੇਟ ਕੇ ਉਹਨੂੰ ਅਮੀਰ ਬਣਾ ਸਕਦੇ ਹਾਂ ਹੈਨਾ ਅਤੇ ਚਲੋ